ਪੂਰੀ ਸਰਦੀਆਂ ਦੇ ਵਿੱਚ ਮੌਸਮ ਦੇ ਵਿੱਚ ਸ਼ੂਟਿੰਗ ਫੋਟੋਆਂ ਖਿੱਚਣੀਆਂ ਥੋੜ੍ਹੀਆਂ ਅਜੀਬ ਜਿਹੀਆਂ ਆਉਂਦੀਆਂ ਨੇ ਥੋੜ੍ਹੀਆਂ ਧੁੰਦਲੀਆਂ ਹੁੰਦੀਆਂ ਨੇ ਉਸ ਟਾਈਮ ਮੌਸਮ ਦੇ ਵਿੱਚ ਵੀ ਥੋੜ੍ਹੀ ਬਹੁਤ ਧੁੰਦਲਾਪਨ ਹੁੰਦਾ ਅਤੇ ਮੌਸਮ ਦੇ ਨਾਲ ਉਸ ਹਿਸਾਬ ਨਾਲ ਫੋਟੋਆਂ ਦੀ ਕਲਿਐਰਟੀ ਨਹੀਂ ਆਉਂਦੀ ਬਸੰਤ ਰੁੱਤ ਦੇ ਵਿੱਚ ਫੋਟੋ ਵਧੀਆ ਆਉਂਦੀ ਆ ਮੌਸਮ ਵੀ ਸਾਫ ਹੁੰਦਾ ਅਤੇ ਉਸ ਟਾਈਮ ਉਹ ਖੁੱਲ੍ਹ ਕੇ ਫੋਟੋਆਂ ਖਿੱਚ ਜਾ ਸਕਦੀਆਂ ਨੇ ਖਿੱਚ ਹੋ ਜਾਂਦੀਆਂ ਨੇ ਮੌਸਮ ਨੂੰ ਅਸਾਂ ਬਸੰਤ ਬਸੰਤ ਰੁੱਤ ਵਿੱਚ ਆਪਾਂ ਬੂਟੇ ਵੀ ਸੋਹਣੇ ਹਰਿਆਲੀ ਵੀ ਸਾਰੇ ਪਾਸੇ ਨਜ਼ਰ ਆਉਂਦੀ ਆ ਬੂਟਿਆਂ ਨੂੰ ਨਵਾਂ ਪੱਤੇ ਆਉਂਦੇ ਆ ਪੱਤਝੜ ਰੁੱਤ ਚਲੀ ਜਾਂਦੀ ਆ ਉਸ ਟਾਈਮ ਜਿਹੜਾ ਮਾਹੌਲ ਹੁੰਦਾ ਨਾ ਫੋਟੋਗ੍ਰਾਫੀ ਦਾ ਬਹੁਤ ਸੋਹਣਾ ਹੁੰਦਾ ਆ ਉਸ ਟਾਈਮ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਮਾਹੌਲ ਦੇ ਵਿੱਚ ਫੋਟੋਆਂ ਖਿੱਚੀਏ ਬਾਕੀ ਮੌਸਮ ਤਾਂ ਗਰਮੀਆਂ ਦੇ ਵਿੱਚ ਵੀ ਠੀਕ ਹੁੰਦਾ ਉਸ ਟਾਈਮ ਥੋੜ੍ਹੀ ਜ਼ਿਆਦਾ ਗਰਮੀ ਆ ਜਾਂਦੀ ਆ ਬਸੰਤ ਰੁੱਤ ਹੀ ਵਧੀਆ ਗਿਣੀ ਜਾਂਦੀ ਹੈ ਉਸ ਰੁੱਤ ਦੇ ਵਿੱਚ ਸੋਹਣੀਆਂ ਫੋਟੋਆਂ ਹੁੰਦੀਆਂ ਨੇ ਸਰਦੀ ਦੇ ਵਿੱਚ ਨਹੀਂ ਹੁੰਦੀ